ਫੋਟੋਗ੍ਰਾਫੀ ਮੇਰਾ ਸ਼ੁਰੂ ਤੋਂ ਹੀ ਸਪਨਾ ਸੀ ਮੈਨੂੰ ਫੋਟੋਗ੍ਰਾਫੀ ਕਰਨਾ ਬਹੁਤ ਹੀ ਪਸੰਦ ਸੀ ਮੈਂ ਫੋਟੋਗ੍ਰਾਫੀ ਵਿੱਚ ਬਹੁਤ ਰੁਚੀ ਰੱਖਦੀ ਹੁੰਦੀ ਸੀ ਛੋਟੇ ਹੁੰਦੇ ਤੋਂ ਹੀ ਮੈਨੂੰ ਫੋਟੋਗ੍ਰਾਫੀ ਦਾ ਵਧੀਆ ਫੋਟੋਗ੍ਰਾਫੀ ਕਰਨਾ ਵਧੀਆ ਲੱਗਦਾ ਸੀ ਅਤੇ ਮੈਂ ਆਪਦੇ ਆਪਣੇ ਘਰਦਿਆਂ ਨੂੰ ਕਿਹਾ ਵੀ ਮੈਂ ਫੋਟੋਗ੍ਰਾਫੀ ਕਰਨਾ ਚਾਹੁੰਦੀ ਹਾਂ ਮੇਰੇ ਘਰਦਿਆਂ ਨੇ ਮੈਨੂੰ ਪੂਰਾ ਹੀ ਸਹਾਈ ਕੀਤਾ ਵੀ ਤੂੰ ਫੋਟੋਗ੍ਰਾਫਰ ਹੀ ਕਰ ਮੈਨੂੰ ਵਧੀਆ ਵਧੀਆ ਫੋਨ ਲਿਆ ਕੇ ਦਿੱਤੇ ਹੋਰ ਵੀ ਬਹੁਤ ਸਹਾਇਤਾ ਕੀਤੀ ਵੀ ਮੈਂ ਫੋਟੋਗ੍ਰਾਫੀ ਵਧੀਆ ਬਣ ਸਕਾਂ ਮੈਂ ਸ਼ੁ ਛੋਟੇ ਹੁੰਦੇ ਤੋਂ ਕਹਿੰਦੀ ਸੀ ਮੈਂ ਫੋਟੋਗ੍ਰਾਫਰ ਬਣਨਾ ਪਰ ਛੋਟਾ ਸ਼ਹਿਰ ਹੋਣ ਕਰਕੇ ਮੈਂ ਫੋਟੋਗ੍ਰਾਫਰ ਨਹੀਂ ਬਣ ਪਾਉਂਦੀ ਸੀ ਕਿਉਂਕਿ ਸਾਡੀ ਇੱਥੇ ਸ਼ਹਿਰ ਦੇ ਵਿੱਚ ਸਹੂਲਤ ਬਹੁਤ ਹੀ ਘੱਟ ਸੀ ਇਹ ਸਹੂਲਤ ਕਰਕੇ ਉਹ ਮੇਰੇ ਘਰਦਿਆਂ ਨੇ ਮੈਨੂੰ ਫਿਰ ਵੀ ਬਹੁਤ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਲਿਜਾ ਕੇ ਫੋਟੋਗ੍ਰਾਫਰਾਂ ਨਾਲ ਮਿਲਾਇਆ ਅਤੇ ਬਹੁਤ ਹੀ ਮੇਰੀ ਹੈ ਮਦਦ ਕੀਤੀ ਜਿਸ ਕਰਕੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਰਹਿੰਦੀ ਹਾਂ ਉ ਉਹ ਮੈਨੂੰ ਹਰ ਹੱਕ ਕਿਤੋਂ ਹੋਰ ਕੋਈ ਕੰਮ ਤੋਂ ਨਹੀਂ ਰੋਕਦੇ ਉਹ ਮੇਰੀ ਹਰ ਕੰਮ ਦੇ ਵਿੱਚ ਸਾਥ ਦਿੰਦੇ ਹੈ ਫੋਟੋਗਰਾਫੀ ਵਿੱਚ ਉਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਫੋਟੋਗ੍ਰਾਫੀ ਕਰਨੀ ਹੈ ਤਾਂ ਉਹਨਾਂ ਨੇ ਕੁਝ ਵੀ ਨਹੀਂ ਕਿਹਾ ਉਹਨਾਂ ਨੇ ਮੈਨੂੰ ਵਧੀਆ ਵਧੀਆ ਫੋਨ ਲਿਆ ਕੇ ਅਤੇ ਵਧੀਆ ਵਧੀਆ ਕੈਮਰੇ ਵਾਲੇ ਕੈਮਰੇ ਲਿਆ ਕੇ ਦਿੱਤੇ ਜਿਸ ਜਿਸ ਨਾਲ ਮੈਂ ਫੋਟੋ ਖਿੱਚ ਸਕਾਂ ਮੈਨੂੰ ਵਧੀਆ ਵਧੀਆ ਜਗ੍ਹਾ 'ਤੇ ਲੈ ਕੇ ਗਏ ਅਤੇ ਆਪ ਸੋਹਣੇ ਜਿਹੇ ਕੱਪੜੇ ਪਾ ਕੇ ਤਿਆਰ ਹੋ ਕੇ ਆਪਣੀਆਂ ਫੋਟੋਆਂ ਖਿਚਵਾਈਆਂ ਹੋਰ ਵੀ ਬਹੁਤ ਕੁਛ ਇਹੋ ਜਿਹੀਆਂ ਚੀਜ਼ਾਂ ਕੀਤੀਆਂ ਉਹਨਾਂ ਨੇ ਮੇਰੇ ਲਈ ਵੀ ਮੈਨੂੰ ਫੋਟੋਆਂ ਦੇ ਵਿੱਚ ਬਹੁਤ ਉਹਨਾਂ ਨੇ ਮਦਦ ਕੀਤੀ ਜਿਸ ਕਰਕੇ ਮੈਂ ਫੋਟੋ ਵਧੀਆ ਖਿੱਚ ਸਕਾਂ ਪਰ ਉਹ ਮੈਨੂੰ ਦੋ ਵੱਡੇ ਵੱਡੇ ਫੋਟੋਗ੍ਰਾਫਰਾਂ ਕੋਲ ਲੈ ਜਾਂਦੇ ਆ ਅਤੇ ਉਹਨਾਂ ਤੋਂ ਮੇਰੀ ਗੱਲਬਾਤ ਕਰਵਾਉਂਦੇ ਜਿਸ ਤੋਂ ਮੈਂ ਬਹੁਤ ਗਿਆਨ ਲਿੱਤਾ ਫੋਟੋਗ੍ਰਾਫਰ ਤਾਂ ਫੋਟੋਗ੍ਰਾਫੀ ਤਾਂ ਮੈਂ ਸੋਸ਼ਲ ਮੀਡੀਆ ਤੋਂ ਵੀ ਬਹੁਤ ਸਿੱਖੀ ਹੈ ਉਹ ਜਿਵੇਂ ਯੂਟੀਊਬ ਵਰਗੀਆਂ ਚੀਜ਼ਾਂ ਤੋਂ ਯੂਟੀਊਬ ਤੋਂ ਮੈਂ ਫੋਟੋਗ੍ਰਾਫੀ ਬਹੁਤ ਸਿੱਖੀ ਉਹਨਾਂ ਨੇ ਮੈਨੂੰ ਕਦੇ ਨਹੀਂ ਰੋਕਿਆ ਵੀ ਤੂੰ ਇਨ ਇਸ ਕੰਮ ਦੇ ਵਿੱਚ ਨਾ ਪੈ ਇਹ ਕੰਮ ਨਹੀਂ ਚੱਲਣਾ ਪਰ ਫਿਰ ਵੀ ਉਹਨਾਂ ਦੇ ਦਿੱਤਾ ਉਹਨਾਂ ਨੇ ਕਿਹਾ ਜੋ ਤੂੰ ਕਰਨਾ ਚਾਹੁੰਦੀ ਹਾਂ ਤੂੰ ਕਰ ਮੈਂ ਇਸ ਕਰਕੇ ਫੋਟੋਗਰਾਫੀ ਮਨ ਲਗਾ ਕੇ ਕੀਤੀ ਅਤੇ ਫੋਟੋਗ੍ਰਾਫੀ ਇੱਕ ਦਿਨ ਬਣ ਕੇ ਹੀ ਰਹੂੰਗੀ ਉਹਨਾਂ ਨੇ ਮੈਨੂੰ ਵਧੀਆ ਤੋਂ ਵਧੀਆ ਕੈਮਰੇ ਬਣਾਏ ਲੈ ਕੇ ਦਿੱਤੇ ਵਧੀਆ ਜਗ੍ਹਾ 'ਤੇ ਲੈ ਕੇ ਗਏ ਅਤੇ ਹੋਰ ਵੀ ਬਹੁਤ ਚੀਜ਼ ਸਾਰੀਆਂ ਚੀਜ਼ਾਂ ਉਹਨਾਂ ਨੇ ਮੇਰੇ ਲਈ ਕੀਤੀਆਂ ਅਤੇ ਇਸ ਕਰਕੇ ਅ ਆਂਢ ਗਆਂਢ ਸਾਡੇ ਗੁਆਂਢੀ ਦੇ ਵਿੱਚ ਇੱਕ ਫੋਟੋਗ੍ਰਾਫਰ ਰਹਿੰਦਾ ਸੀ ਉਹ ਮੈਨੂੰ ਹਰ ਰੋਜ਼ ਉੱਥੇ ਲੈ ਕੇ ਜਾਂਦੇ ਅਤੇ ਉਸ ਨਾਲ ਗੱਲਬਾਤ ਕਰਾਵਾਉਂਦੇ ਅਤੇ ਉਹਨਾਂ ਤੋਂ ਮੈਂ ਬਹੁਤ ਗਿਆਨ ਲੈਂਦੀ ਹੁੰਦੀ ਸੀ ਫੋਟੋਗ੍ਰਾਫੀ ਦਾ ਫੋਟੋਗਰਾਫੀਆਂ ਦੇ ਵਿੱਚ ਮੈਨੂੰ ਪਹਾੜਾਂ ਤੇ ਲੈ ਕੇ ਜਾਂਦੇ ਪਹਾੜਾਂ ਦੇ ਵਿੱਚ ਜਾ ਕੇ ਮੈਂ ਫੋਟੋਆਂ ਖਿੱਚਣੀਆਂ ਅਤੇ ਉਸਨੂੰ ਉਹਨਾਂ ਨੇ ਮੈਨੂੰ ਪੀ ਸੀ ਵੀ ਲੈ ਕੇ ਦਿੱਤਾ ਜਿ ਜਿਸ ਨਾਲ ਮੈਂ ਕੀ ਨਾਮ ਹੈ ਐਡੀਟਿੰਗ ਕਰਦੀ ਹੁੰਦੀ ਸੀ ਅਤੇ ਕ ਕਰਦੀ ਹੁੰਦੀ ਸੀ ਅਤੇ ਹੋਰ ਵੀ ਮੈਂ ਬਹੁਤ ਚੀਜ਼ਾਂ ਕੀਤੀਆਂ ਉਹਨਾਂ ਨੇ ਮੈਨੂੰ ਹਰ ਇੱਕ ਖਵਾਹਿਸ਼ ਮੇਰੀ ਪੂਰੀ ਕੀਤੀ ਫੋਟੋਗ੍ਰਾਫੀ ਰ ਪ੍ਰਤੀ ਤੇ ਅਤੇ ਮੈਨੂੰ ਹਰ ਇੱਕ ਚੀਜ਼ ਲੈ ਕੇ ਦਿੱਤੀ ਧੰਨਵਾਦ